ਹੈਲੋ ਹਾਂਜੀ ਹਾਂਜੀ ਹਾਂ ਵਧੀਆ ਤੁਸੀਂ ਦੱਸੋ ਹਾਂਜੀ ਹਾਂ ਇੱਥੇ ਆਪਣੇ ਪਟਿਆਲੇ 'ਚ ਤਾਂ ਜੀ ਬਹੁਤ ਬੁਰਾ ਹਾਲ ਹੈ ਇੱਕ ਆਹ ਜਿਹੜਾ ਨਵਾਂ ਬੱਸ ਸਟੈਂਡ ਬਣਿਆ ਇਹਦੇ ਕਰਕੇ ਬੜੀ ਦਿੱਕਤ ਆਉਂਦੀ ਹੈ ਹਾਂਜੀ ਹਾਂਜੀ ਫਿਰ ਬੰਦਾ ਆਪਣੇ ਕੰਮ 'ਤੇ ਜਾਣ ਤੋਂ ਵੀ ਜੋਬ ਵਗੈਰਾ 'ਤੇ ਜਾਣ ਤੋਂ ਵੀ ਲੇਟ ਹੋ ਜਾਂਦਾ ਹਾਂਜੀ ਹਾਂ ਬੱਤੀਆਂ ਵੀ ਬਹੁਤ ਨੇ ਕੁ ਫਿਰ ਇਹ ਬੱਸ ਸਟੈਂਡ ਕਰਕੇ ਬੱਸਾਂ ਲੈਣ ਦੀ ਵੀ ਦਿੱਕਤ ਆਉਂਦੀ ਹੈ ਪਹਿਲਾਂ ਤਾਂ ਪੁਰਾਣੇ ਸਟੈਂਡ 'ਤੇ ਬੰਦਾ ਸਿੱਧਾ ਉੱਥੇ ਪਹੁੰਚ ਜਾਂਦਾ ਸੀ ਇਹ ਫਿਰ ਬੱਸਾਂ ਉੱਥੇ ਕਈ ਨਹੀਂ ਰੁਕਦੀਆਂ ਹੈਗੀਆਂ ਫਿਰ ਓਟੋ ਲੈਣਾ ਪੈਂਦਾ ਹਾਂਜੀ ਹਾਂ ਮੈਂ ਵੀ ਜਦੋਂ ਆਪਣੀ ਕਲਾਸਾਂ ਲਾਉਣ ਜਾਂਦੀ ਹੁੰਦੀ ਸੀ ਉੱਥੇ ਮੈਨੂੰ ਬੜੀ ਦਿੱਕਤ ਆਉਂਦੀ ਸੀਗੀ ਮੈਂ ਹਮੇਸ਼ਾ ਲੇਟ ਹੋ ਜਾਂਦੀ ਸੀਗੀ ਆਪਣੀ ਕਲਾਸ ਲਾਉਣ ਤੋਂ ਹਾਂਜੀ ਹਾਂ ਬਿਲਕੁਲ ਹਾਂਜੀ ਉੱਤੋਂ ਦਿਨ ਵੀ ਤੁਹਾਨੂੰ ਪਤਾ ਫਿਰ ਠੰਡਾਂ 'ਚ ਛੋਟੇ ਹੋ ਜਾਂਦੇ ਨੇ ਹਾਂਜੀ ਹਾਂਜੀ ਹੁਣ ਮੈਂ ਵੀ ਕੰਮ 'ਤੇ ਜਾਣਾ ਬਸ ਹੁਣ ਕੰਮ 'ਤੇ ਜਾਣ ਲਈ ਵੀ ਫਿਰ ਬੰਦੇ ਨੂੰ ਉੱਨਾ ਹੀ ਜਲਦੀ ਨਿਕਲਣਾ ਪੈਂਦਾ ਹਾਂਜੀ ਹਾਂਜੀ ਉਹੀ ਤਾਂ ਹੈ ਜਿੱਥੇ ਆਪਾਂ ਅੱਧਾ ਘੰਟਾ ਪਹਿਲਾਂ ਨਿਕਲਦੇ ਸੀ ਹੁਣ ਆਪਾਂ ਨੂੰ ਘੰਟਾ ਪਹਿਲਾਂ ਨਿਕਲਣਾ ਪੈਂਦਾ ਹਾਂਜੀ ਹਾਂ ਹਾਂਜੀ ਹਾਂ ਠੀਕ ਹੈ ਜੀ ਹਾਂਜੀ ਹਾਂਜੀ ਓਕੇ ਜੀ